ਮਾਰ੍ਹਾ ਮਾਰ੍ਹਾ ਭਾਈ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਠਾਕ ਆ ਵਧੀਆ ਜੀ ਹੋਰ ਕਿੱਦਾਂ ਸਿਹਤ ਅੱਛਾ ਤੁਹਾਨੂੰ ਤੁਸੀਂ ਭਾਅ ਜੀ ਆ ਗਏ ਇੱਥੇ ਕਦੋਂ ਦੇ ਆਏਦੇ ਹੋ ਅੱਛਾ ਅੱਛਾ ਅੱਛਾ ਦੁੱਧ ਦਹੀਂ ਦਾ ਲੈਣਾ ਤੁਸੀਂ ਦੁਕਾਨਦਾਰ ਨਹੀਂ ਪਤਾ ਅੱਛਾ ਇੱਕ ਤਾਂ ਦੁਕਾਨ ਇੱਥੇ ਮੇਨ ਆ ਭਿੰਡਰ ਡੇਰੀ ਆ ਬੜੀ ਮਸ਼ਹੂਰ ਬਸ ਸਟੈਂਡ ਲਾਗੇ ਅਤੇ ਉਹਦਾਂ ਉਹ ਉਹਨਾਂ ਦਾ ਰੇਟ ਵੀ ਸਹੀ ਹੈ ਦੁੱਧ ਵੀ ਸਹੀ ਹੈ ਅਤੇ ਮੇਰੇ ਖਿਆਲ ਦੁੱਧ ਮਿਲ ਜਾਣਾ ਤੁਹਾਨੂੰ ਸੱਠ ਰੁਪਏ ਕਿਲੋ ਅਤੇ ਅੱਸੀ ਰੁਪਏ ਕਿਲੋ ਦਹੀ ਮਿਲ ਜਾਣਾ ਹਾਂਜੀ ਖੁੱਲ੍ਹੀ ਜੀ ਉਹ ਸਵੇਰੇ ਤੜਕੇ ਪੰਜ ਵਜੇ ਖੁੱਲ੍ਹ ਜਾਂਦੀ ਹੈ ਦੁੱਧੀ ਆ ਜਾਂਦੇ ਉਹਦੇ ਕੋਲ ਆਪਣਾ ਹੀ ਦੁੱਧ ਹੈ ਆਪਣਾ ਹੀ ਪਲਾਂਟ ਆ ਉਹਨਾਂ ਦਾ ਅਤੇ ਸ਼ਾਮ ਤੱਕ ਨੌ ਦਸ ਵਜੇ ਤੱਕ ਖੁੱਲ੍ਹੀ ਹੈ ਜੀ ਪਨੀਰ ਵੀ ਮਿਲ ਜਾਣਾ ਤੁਹਾਨੂੰ ਤਿੰਨ ਕੁ ਸੌ ਰੁਪਏ ਨੂੰ ਕਿਲੋ ਮਿਲ ਜਾਣਾ ਉੱਥੋਂ ਭਾਵੇਂ ਤੁਸੀਂ ਜੇ ਵਿਆਹ ਸ਼ਾਦੀ ਲਈ ਲੈਣਾ ਵੱਧ ਲੈਣਾ ਕੋਈ ਕੁਇੰਟਲ ਦੋ ਕੁਇੰਟਲ ਅਤੇ ਉਹ ਤੁਸੀਂ ਇੱਕ ਦਿਨ ਪਹਿਲਾਂ ਦੱਸਣਾ ਬਸ ਹਾਂ ਰੇਟ ਬਹੁਤ ਸਹੀ ਆ ਅਤੇ ਇੱਕ ਦੁਕਾਨ ਹੋਰ ਹੈ ਸੈਣੀਆਂ ਦੀ ਤਾਰਾਗੜ੍ਹ ਮੋੜ 'ਤੇ ਨਾਨੂ ਦੀ ਹੱਟੀ ਅਤੇ ਉਹਨਾਂ ਦਾ ਵੀ ਰੇਟ ਬਹੁਤ ਵਧੀਆ ਉਹ ਉਹ ਉਹਨਾਂ ਦਾ ਵੀ ਚਾਲੀ ਰੁਪਏ ਕਿਲੋ ਦੁੱਧ ਵੀ ਹੈਗਾ ਇੱਕ ਪੰਜਾਹ ਰੁਪਏ ਕਿਲੋ ਵੀ ਦੁੱਧ ਹੈਗਾ ਅਤੇ ਦਹੀਂ ਤੁਹਾਨੂੰ ਉੱਥੇ ਵੀ ਅੱਸੀ ਰੁਪਏ ਹੀ ਮਿਲਣਾ ਉਹ ਤਾਰਾਗੜ੍ਹ ਮੋੜ 'ਤੇ ਆ ਜੀ ਜੀ ਟੀ ਰੋਡ ਦੇ ਉੱਤੇ ਦੀਨਾਨਗਰ ਹਾਂ ਜੀ ਹਾਂ ਜੀ ਹਾਂ ਜੀ ਅਤੇ ਇਹ ਦੋ ਜਗ੍ਹਾ ਮੇਨ ਹੈ ਅਤੇ ਇੱਕ ਹੋਰ ਹੈ ਡੇਰੀ ਹੈ ਤੇਰੇ ਭੂਤ ਨਾਥ ਮੰਦਰ ਲਾਗੇ ਹੈ ਚਮਨ ਲਾਲ ਸ਼ਰਮਾ ਦੀ ਡੇਰੀ ਹਾਂ ਅਤੇ ਤੁਹਾਨੂੰ ਜ਼ਿਆਦਾ ਬਸ ਸਟੈਂਡ ਵਾਲੀ ਲਾਗੇ ਰਹਿਣੀ ਆ ਠੀਕ ਹੈ ਜੀ ਅਤੇ ਜਾਂ ਰਹਿਣੀ ਆ ਤੁਹਾਨੂੰ ਨਾਨੂ ਦੀ ਠੀਕ ਹੈ ਜੀ ਚੰਗਾ ਜੀ ਚੰਗਾ